ਹੈਲੋ ਤੁਸੀਂ ਅਮਨ ਸ਼ੋਪਕੀਪਰ ਬੋਲ ਰਹੇ ਹੋ ਮੈਂ ਦੋ ਦਿਨ ਪਹਿਲਾਂ ਤੁਹਾਡੇ ਕੋਲ ਗੋਗਲਸ ਅਤੇ ਸਪੈਕਸ ਖਰੀਦੀ ਸੀ ਅਤੇ ਉਹਦੀ ਡੰਡੀ ਉਹਦੀ ਇੱਕ ਸਪੈਕਸ ਦੀ ਡੰਡੀ ਟੁੱਟ ਗਈ ਹੈ ਅਤੇ ਗੋਗਲਸ 'ਤੇ ਸਕ੍ਰੈਚ ਆ ਗਏ ਨੇ ਉਦੋਂ ਤਾਂ ਸਹੀ ਸੀ ਬਾਅਦ 'ਚ ਗਲਤੀ ਨਾਲ ਟੁੱਟ ਗਈ ਹੈ ਅਤੇ ਕੀ ਤੁਸੀਂ ਅਸਕ ਅਕਸਚੇਂਜ ਕਰ ਦੋਂਗੇ ਨਹੀਂ ਇੰਨੀ ਜਲਦੀ ਐਨੀ ਜਲਦੀ ਡੰਡੀ ਕਿਵੇਂ ਟੁੱਟ ਸਕਦੀ ਹੈ ਤੁਸੀਂ ਪ੍ਰੋਡਕਟ ਹੀ ਨਹੀਂ ਵਧੀਆ ਸਾਨੂੰ ਦਿੱਤਾ ਤੁਸੀਂ ਕਿਵੇਂ ਇਹ ਤਾਂ ਨਹੀਂ

ਪਰ ਤੁਹਾਡੇ ਕੋਲੋਂ ਤਾਂ ਮੈਂ ਕੰਪਨੀ ਦੀ ਚੀਜ਼ ਮੰਗੀ ਸੀ ਤੁਸੀਂ ਮੈਨੂੰ ਉਹ ਵਧੀਆ ਨਹੀਂ ਦਿੱਤੀ ਹੁਣ ਤੁਹਾਡੀ ਗਲਤੀ ਹੈਗੀ ਹੈ ਹੁਣ ਇੰਨੇ ਪੈਸੇ ਵਾਰ ਕੇ ਵੀ ਤੁਸੀਂ ਸਹੀ ਚੀਜ਼ ਨਹੀਂ ਦਿੰਦੇ ਪਏ ਤੁਸੀਂ ਐਕਸਚੇਂਜ ਕਰਨਾ ਤੁਹਾਡਾ ਕੰਮ ਹੈ ਤੁਸੀਂ ਮੈਨੂੰ ਕੰਪਨੀ ਦੀ ਚੀਜ਼ ਦਿੱਤੀ ਨਹੀਂ ਤੁਸੀਂ ਡੁਪਲੀਕੇਟ ਦਿੱਤੀ ਹੈ ਘਰ ਜਾਂਦੇ ਟੁੱਟ ਗਈ ਹੁਣ ਸਾਡੀ ਗਲਤੀ ਤੁਹਾਡਾ ਫਰਜ਼ ਬਣਦਾ ਐਕਸਚੇਂਜ ਕਰਕੇ ਦੇਣਾ ਨਹੀਂ ਦਿੱਤੀ ਕੰਪਨੀ ਦੀ ਇੰਨੀ ਜਲਦੀ ਟੁੱਟ ਜਾਂਦੀ ਹੁੰਦੀ ਹੈ ਲੋਗੋ ਤਾਂ ਕੋਈ ਵੀ ਲਗਵਾ ਲਵੇਗਾ ਇਹਦਾ ਕੀ ਮਤਲਬ ਉਹ ਚੀਜ਼ ਟੁੱਟੀ ਤੁਸੀਂ ਐਕਸਚੇਂਜ ਕਰ ਕੇ ਦਿਓਗੇ ਕੇ ਨਹੀਂ ਕਿੰਨੀ ਦੇਰ ਲੱਗ ਜਾਵੇਗੀ ਇਸ 'ਚ ਨਹੀਂ ਥੋੜ੍ਹਾ ਜਲਦੀ ਕਰਕੇ ਦਿਓ ਨਹੀਂ ਤੁਸੀਂ ਤੁਸੀਂ ਕੰਪਨੀ ਵਾਲਿਆਂ ਨੂੰ ਕਹੋ ਥੋੜ੍ਹਾ ਜਿਹਾ ਜਲਦੀ ਕਰੋ ਨਹੀਂ ਇੰਨਾ ਦੋ ਦਿਨ ਬਹੁਤ ਜ਼ਿਆਦਾ ਨੇ ਜਾਂ ਤੁਸੀਂ ਐਂ ਕਰੋ ਤੁਸੀਂ ਮਤਲਬ ਵੀ ਸੇਮ ਆਪਣੀ ਸ਼ੋਪ 'ਚ ਦੇ ਦਿਓ ਅਤੇ ਬਾਅਦ 'ਚ ਜੋ ਐਕਸਚੇਂਜ ਹੋਈ ਤੁਸੀਂ ਰੱਖ ਲਿਆ ਜੇ ਅਤੇ ਹੁਣ ਮੈਨੂੰ ਜਿਹੜਾ ਮਤਲਬ ਲੋਸ ਹੋਇਆ ਇੰਨਾ ਮੈਂ ਕਿਤੇ ਜਾਣਾ ਹੈ ਅਤੇ ਮੈਂ ਇਸ ਚੀਜ਼ ਲਈ ਬੈਠੀ ਰਹਾਂ ਇੱਥੇ ਠੀਕ ਹੈ ਕੋਈ ਨਾ ਮੈਂ ਆਜੂ